ਮੇਰੇ ਕੋਲ ਕੋਈ ਮਨਪਸੰਦ ਬੁਣਾਈ ਅਤੇ ਸਿਲਾਈ ਦੀ ਬੁੱਕ ਤਾਂ ਨਹੀਂ ਹੈ ਪਰ ਮੇਰੇ ਮੰਮਾ ਨੇਗੇ ਜਿਹਨਾਂ ਤੋਂ ਮੈਂ ਸਾਰਾ ਕੁਛ ਸਿੱਖਿਆ ਹੈਗਾ ਬੁਣਾਈ ਦਾ ਸਿਲਾਈ ਦਾ ਸਾਰਾ ਕੁਛ ਮੈਂ ਉਹਨਾਂ ਤੋਂ ਹੀ ਸਿੱਖਦੀ ਹਾਂ ਮਤਲਬ ਮੈਂ ਉਹਨਾਂ ਤੋਂ ਛੋਟੇ ਹੁੰਦਿਆਂ ਤੋਂ ਦੇਖਦੇ ਆ ਰਹੇ ਹਾਂ ਵੀ ਮੰਮਾ ਐਵੇਂ ਕਰਦੇ ਨੇ ਐਵੇਂ ਕਰਦੇ ਨੇ ਹੌਲੀ ਹੌਲੀ ਉਸ ਚੀਜ਼ 'ਚ ਇੰਟਰਸਟ ਪੈ ਗਿਆ ਅਤੇ ਮੈਨੂੰ ਸਿਲਾਈ ਬੁਣਾਈ ਦਾ ਕੰਮ ਆ ਗਿਆ ਸੀ ਮੇਰਾ ਸੋਸ਼ਲ ਮੀਡੀਆ 'ਤੇ ਕੋਈ ਅਕਾਊਂਟ ਨਹੀਂ ਹੈਗਾ ਮੈਂ ਉਹਨੂੰ ਮੰਮਾ ਤੋਂ ਹੀ ਸਿੱਖਿਆ ਏ ਸਾਰਾ ਕੁਛ ਜੋ ਵੀ ਸਿੱਖਿਆ ਹੈਗਾ ਜਿਵ ਜਿਵੇਂ ਜਿਵੇਂ ਉਹ ਬਣਾਉਂਦੇ ਸੀਗੇ ਸਿਲਾਈ ਕਰਦੇ ਸੀ ਨਵੇਂ ਨਵੇਂ ਆਈਡੀਆਜ਼ ਉਹਨਾਂ ਨੂੰ ਲੱਭ ਲੱਭ ਕੇ ਦੇਣੇ ਵੀ ਹਾਂ ਤੁਸੀਂ ਐਵੇਂ ਕਰ ਲਉ ਉਵੇਂ ਕਰ ਲਉ ਜਾਂ ਮੈਂ ਆਹ ਚੀਜ਼ ਇੱਥੇ ਐਵੇਂ ਦੇਖੀ ਸੀ ਤੁਸੀਂ ਐਵੇਂ ਕਰਕੇ ਦੇਖ ਲਓ ਮੈਨੂੰ ਐਵੇਂ ਦੱਸ ਦਿਉ ਕਿਵੇਂ ਕਰਨਾ ਹੈਗਾ ਇਹ ਉਹ ਸਾਰਾ ਕੰਮ ਮੈਂ ਆਪਣੀ ਮੰਮਾ ਤੋਂ ਹੀ ਸਿੱਖਿਆ ਏ ਆ ਅਤੇ ਆਪਣੇ ਸਮਾਜ ਦੇ ਵਿੱਚ ਮੈਂ ਇਸ ਚੀਜ਼ ਦੀ ਮਸ਼ਹੂਰੀ ਮਸ਼ਹੂਰੀ ਕੀ ਮਤਲਬ ਮੈਂ ਦੱਸ ਸਕਦੀ ਹਾਂ ਵੀ ਹਾਂ ਮੇਰੇ 'ਚ ਆਹ ਹੁਨਰ ਆ ਮੈਂ ਨਵੀਆਂ ਨਵੀਆਂ ਜੈਕਟਾਂ ਬਣਾਉਂਦੀ ਹਾਂ ਤਾਂ ਸਾਡੀ ਆਂਢ ਗਵਾਂਢ ਦੇ ਵਿੱਚ ਕਈ ਲੋਕ ਲੈ ਲੈਂਦੇ ਨੇ ਉਸ ਚੀਜ਼ ਨੂੰ ਵੀ ਉਹਨਾਂ ਨੂੰ ਪਸੰਦ ਲੱਗਦੀ ਆ ਫਿਰ ਅੱਗੇ ਅੱਗੇ ਜਾ ਕੇ ਉਹ ਹੋਰ ਅੱਗੇ ਰਿਸ਼ਤੇਦਾਰਾਂ ਕੋਲ ਦੱਸਦੇ ਨੇਗੇ ਫਿਰ ਮੈਂ ਆਪਣੇ ਫ੍ਰੈਂਡ ਸਰਕਲ ਦੇ ਵਿੱਚ ਦਿੰਦੀ ਹਾਂ ਜਦੋਂ ਮੈਂ ਗਿਫਟ ਵਗੈਰਾ ਦਿੰਦੀ ਹਾਂ ਤਾਂ ਉਹ ਉਦੋਂ ਮੈਂ ਬੁਣਾਈ ਬਣਾ ਕੇ ਹੀ ਦਿੰਦੀ ਹਾਂ ਹੱਥ ਨਾਲ ਕੁਛ ਕੋਈ ਕੋਈ ਨਾ ਕੋਈ ਚੀਜ਼ ਆਪਣੇ ਫਰੈਂਡਸ ਨੂੰ ਵੀ ਉਹਨਾਂ ਨੂੰ ਅੱਗੇ ਅੱਗੇ ਉਹ ਦੱਸਦੇ ਨੇ ਵੀ ਹਾਂ ਸਾਡੀ ਫਰੈਂਡ ਨੇ ਬਣਾਇਆ ਫਿਰ ਐਵੇਂ ਐਵੇਂ ਸਾਰਾ ਅੱਗੇ ਅੱਗੇ ਸਰਕਲ ਚੱਲੀ ਜਾਂਦਾ ਏ ਅੱਗੇ ਤੋਂ ਅੱਗੇ ਦੱਸੀ ਜਾਂਦੇ ਨੇਗੇ ਪੁੱਛੀ ਜਾਂਦੇ ਨੇਗੇ ਐਵੇਂ ਹੀ ਸਾਡੇ ਘਰ ਬਹੁਤ ਸਾਰਾ ਔਡਰ ਆਉਂਦੇ ਨੇ ਵੀ ਹਾਂ ਤੁਸੀਂ ਸਾਡਾ ਆ ਸ ਬੁਣ ਬੁਣ ਦੋ ਜਾਂ ਸੂਟ ਵਗੈਰਾ ਸਟਿੱਚ ਕਰਨੇ ਹੁੰਦੇ ਨੇ ਮੰਮਾ ਕੋਲ ਉਹ ਆਉਂਦੇ ਰਹਿੰਦੇ ਨੇ ਤਾਂ ਫਿਰ ਮੈਂ ਆਪਣੀ ਮੰਮਾ ਦੀ ਹੈਲਪ ਕਰ ਦਿੰਦੀ ਹਾਂ ਥੋੜ੍ਹੀ ਬਹੁਤੀ ਜਿਵੇਂ ਕਰਨੀ ਹੁੰਦੀ ਆ ਕਿਉਂਕਿ ਮੈਂ ਵੀ ਇੱਕ ਵਰਕਿੰਗ ਹਾਂ ਇਸ ਲਈ ਮੇਰੇ ਕੋਲ ਵੀ ਟਾਈਮ ਨਹੀਂ ਹੁੰਦਾ ਪਰ ਜਦੋਂ ਟਾਈਮ ਚਾਹੀਦਾ ਹੁੰਦਾ ਆ ਮੰਮਾ ਨੂੰ ਵੀ ਆਹ ਤੁਸੀਂ ਇਹ ਚੀਜ਼ ਬਣਾਉਣੀ ਆ ਟਾਈਮ 'ਤੇ ਦੇਣੀ ਆ ਤਾਂ ਉਦੋਂ ਮੈਂ ਥੋੜ੍ਹੀ ਜਿਹੀ ਹੈਲਪ ਕਰਵਾ ਦਿੰਦੀ ਹਾਂ ਬੁਣਾਈ ਵਾਲਾ ਕੰਮ ਮੈਂ ਜ਼ਰੂਰ ਕਰ ਲੈਂਦੀ ਹਾਂ ਕਿਉਂਕਿ ਉਹ ਤਾਂ ਕਿਤੇ ਵੀ ਕੀਤਾ ਜਾ ਸਕਦਾ ਏ ਆ